ਹੈਲ ਸਤਿ ਸ਼੍ਰੀ ਅਕਾਲ ਜੋਤੀ ਬੋਲ ਰਹੇ ਆ ਸਤਿ ਸ਼੍ਰੀ ਅਕਾਲ ਮੈਂ ਜੋਤੀ ਦੀ ਇੰਗਲਿਸ਼ ਦੀ ਮੈਮ ਬੋਲ ਰਹੀ ਹਾਂ ਉਹਦੀ ਕਲਾਸ ਟੀਚਰ ਬੋਲ ਰਹੀ ਹਾਂ ਜੋਤੀ ਨੇ ਐਕਚੁਲੀ ਹੁਣ ਹਾਂਜੀ ਐਕਚੁਲੀ ਹੁਣੇ ਨਾ ਜੋਤੀ ਦਾ ਰਿਜਲਟ ਆਇਆ ਸੀ ਫਸਟ ਯੂਨਿਟ ਦਾ ਹਾਂਜੀ ਤੁਸੀਂ ਮੇ ਬੀ ਸ਼ਾਇਦ ਪੀ ਟੀ ਐੱਮ 'ਚ ਨਹੀਂ ਆ ਪਾਏ ਉਹਨੇ ਮੈਨੂੰ ਦੱਸਿਆ ਸੀ ਤੁਹਾਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਸੀ ਉਹਦਾ ਰਿਜਲਟ ਬਹੁਤ ਵਧੀਆ ਆਇਆ ਹੈ ਪਹਿਲਾਂ ਨਾਲੋਂ ਬਹੁਤ ਵਧੀਆ ਉਹਨੇ ਪ੍ਰਦਰਸ਼ਨ ਕੀਤਾ ਹੈ ਉਹ ਕਲਾਸ ਫਸਟ ਆਈ ਹੈ ਹਾਂਜੀ ਉਹ ਕੁੜੀ ਤੁਹਾਡੀ ਬਹੁਤ ਪਿਆਰੀ ਹੈਗੀ ਆ ਹਮੇਸ਼ਾਂ ਬੱਚਿਆਂ ਦੀ ਸਹਾਇਤਾ ਕਰਦੀ ਰਹਿੰਦੀ ਆ ਜੇ ਉਹਨੂੰ ਅਸੀਂ ਕਹੀਏ ਨਾ ਕਿ ਤੁਸੀਂ ਇਹ ਕੰਮ ਨਹੀਂ ਕਰਨਾ ਉਹ ਕੁੜੀ ਤੁਹਾਡੀ ਜੋਤੀ ਕਦੇ ਉਹ ਕੰਮ ਨਹੀਂ ਕਰਦੀ ਹੈਗੀ ਆ ਹਾਂਜੀ ਮੈਂ ਇਹ ਪੁੱਛਣਾ ਸੀਗਾ ਜੋਤੀ ਹੋਰ ਕਿਹੜੇ ਡਾਂਸ 'ਚ ਬਹੁਤ ਜ਼ਿਆਦਾ ਉਹ ਪਾਰਟੀਸਪੇਟ ਕਰਦੀ ਹੈ ਡਾਂਸ ਹਾਂਜੀ ਸਾਡੇ ਸਕੂਲ 'ਚ ਇਕ ਡਾਂਸ ਕੋਂਪੀਟੀਸ਼ਨ ਹੋ ਰਹੀ ਹੈ ਬਾਹਰ ਜਾਣ ਲਈ ਇੰਟਰ ਸਕੂਲ ਮੈਂ ਚਾਹੰਦੀ ਤੁਸੀਂ ਉਹਨੂੰ ਪ੍ਰੋਤਸਾਹਿਤ ਕਰੋ ਕਿ ਉਹ ਉਹਦੇ 'ਚ ਪਾਰਟ ਲਵੇ ਉਹ ਉਹਦੇ 'ਚ ਪਾਰਟ ਲੈਣ ਲਈ ਘਬਰਾ ਰਹੀ ਹੈ ਥੈਂਕ ਯੂ ਥੈਂਕ ਯੂ ਫੋਰ ਚੰਗਾ